ਕੁਝ ਸਾਲ ਪਹਿਲਾਂ ਦੇ ਮੋਬਾਈਲ ਅਤੇ ਮੌਜੂਦਾ ਸਮਾਰਟਫੋਨ ਦੇ ਵਿੱਚ ਬਹੁਤ ਹੀ ਵੱਡਾ ਫਰਕ ਆ ਚੁੱਕਾ ਹੈ ਪਹਿਲੇ ਅਸੀਂ ਆਪਣੇ ਬੱਚਿਆਂ ਨੂੰ ਔਨਲਾਈਨ ਪੜ੍ਹਾ ਨਹੀਂ ਸੀ ਸਕਦੇ ਜੋ ਕਿ ਹੁਣ ਸਮਾਰਟ ਫੋਨ ਦੇ ਨਾਲ ਅਸੀਂ ਉਹਨਾਂ ਨੂੰ ਪੜ੍ਹਾ ਵੀ ਆਰਾਮ ਨਾਲ ਸਕਦੇ ਹਾਂ ਔਨਲਾਈਨ ਕਲਾਸਾਂ ਵੀ ਬਹੁਤ ਆਰਾਮ ਨਾਲ ਲਗਾ ਸਕਦੇ ਹਾਂ ਪਹਿਲੇ ਸ਼ੋਸ਼ਲ ਮੀਡੀਆ ਵਰਗੇ ਪਲੇਟਫੋਰਮ ਵੀ ਨਹੀਂ ਸੀ ਜਿੱਥੇ ਕਿ ਆਪਣੀ ਗੱਲ ਅਸੀਂ ਰੱਖ ਸਕੀਏ ਹੁਣ ਸ਼ੋਸ਼ਲ ਮੀਡੀਆ ਵਰਗੇ ਪਲੈਟਫੋਰਮ ਜਿਸ ਤਰ੍ਹਾਂ ਕਿ ਫੇਸਬੁੱਕ ਇੰਸਟਾਗ੍ਰਾਮ ਕਈ ਪ੍ਰਕਾਰ ਦੇ ਹੋਰ ਵੀ ਆ ਗਏ ਹਨ ਜਿਸ ਨਾਲ ਅਸੀਂ ਆਪਣੇ ਫੋਨ ਤੋਂ ਹੀ ਬੈਠੇ ਬੈਠੇ ਆਪਣੀ ਗੱਲ ਸਰਕਾਰ ਤੱਕ ਜਾਂ ਕਿਸੇ ਵੀ ਦੁਨੀਆ ਦੇ ਕਿਸੇ ਕੋਨੇ ਦੇ ਵੀ ਵਿਅਕਤੀ ਤੱਕ ਪਹੁੰਚਾ ਸਕਦੇ ਹਾਂ ਅੱਜ ਦੇ ਸਮਾਰਟ ਫੋਨ ਦੇ ਨਾਲ ਅਸੀਂ ਜੀ ਪੀ ਆਰ ਐੱਸ ਸਿਸਟਮ ਵੀ ਲੱਗਾ ਹੁੰਦਾ ਹੈ ਜੋ ਕਿ ਸਾਨੂੰ ਕਿਤੇ ਜਾਣ ਲਈ ਬਹੁਤ ਮਦਦ ਕਰਦਾ ਹੈ ਅਸੀਂ ਰਸਤਾ ਸਾਨੂੰ ਨਹੀਂ ਪਤਾ ਤਾਂ ਉਹ ਵੀ ਸਾਨੂੰ ਬੜੇ ਆਰਾਮ ਨਾਲ ਮੁਹਈਆ ਕਰਵਾ ਦਿੰਦਾ ਹੈ ਜੋ ਕਿ ਅੱਜ ਤੋਂ ਕੁਛ ਸਾਲ ਪਹਿਲਾਂ ਦੇ ਮੋਬਾਈਲ ਫੋਨਾਂ ਦੇ ਵਿੱਚ ਨਹੀਂ ਸੀ ਅੱਜ ਜਿਹੜਾ ਮੈਂ ਨੈਟਵਰਕ ਕਨੈਕਸ਼ਨ ਅੱਜ ਜੋ ਨੈਟਵਰਕ ਕਨੈਕਸ਼ਨ ਫਾਈਵ ਜੀ ਚਲਦਾ ਪਿਆ ਹੈ ਜਾਂ ਫ਼ੋਰ ਜੀ ਵਰਤ ਰਹੇ ਹਾਂ ਉਹ ਬਹੁਤ ਹੀ ਤੇਜ ਅਤੇ ਸੰਤੁਸ਼ਟ ਕਰਨ ਵਾਲਾ ਹੈ ਇਸ ਦੇ ਨਾਲ ਨੈੱਟ ਦੀ ਸਪੀਡ ਬਹੁਤ ਹੀ ਵਧੀਆ ਚਲਦੀ ਹੈ ਅਸੀਂ ਕੁਛ ਵੀ ਡਾਊਨਲੋਡ ਜਾਂ ਅਪਲੋਡ ਕਰਨਾ ਹੁੰਦਾ ਹੈ ਉਹ ਬੜਾ ਹੀ ਤੇਜ਼ੀ ਨਾਲ ਹੋ ਜਾਂਦਾ ਹੈ ਮੈਂ ਇਸ ਵੇਲੇ ਜੀਓ ਦੀ ਸਿੰਮ ਵਰਤ ਰਿਹਾ ਹਾਂ ਉਸਦਾ ਡਾਟਾ ਪੈਕ ਦਾ ਮਹੀਨੇ ਦਾ ਖਰਚਾ ਤਕਰੀਬਨ ਢਾਈ ਕੁ ਸੌ ਰੁਪਈਆ ਹੈ ਜੋ ਕਿ ਬਹੁਤ ਹੀ ਅਫੋਰਡੇਬਲ ਹੈ